ਹਾਂ ਮੈਂ ਅਜਿਹੀ ਖੇਡ ਖੇਡੀ ਹੈ ਜਿ ਜਿਸ ਵਿੱਚ ਮੈਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਫੁੱਟਬੋਲ ਫੁੱਟਬੋਲ ਖੇਡਦੇ ਟਾਈਮ ਮੈਨੂੰ ਸਾਹ ਬੜੀ ਛੇਤੀ ਚੜ੍ਹ ਜਾਂਦਾ ਸੀ ਅਤੇ ਥੱਕ ਜਾਂਦਾ ਮੈਨੂੰ ਇੰਜਰੀ ਹੋ ਜਾਂਦੀ ਅਤੇ ਵਾਰ ਵਾਰ ਡਿੱਗਦਾ ਰਹਿੰਦਾ ਸੀ ਅਤੇ ਮੇਰੇ ਕੋਚ ਸਾਹਿਬ ਨੇ ਮੈਨੂੰ ਸਾਂਭਿਆ ਉਦੋਂ ਉਹਨਾਂ ਨੇ ਕਿਹਾ ਕਿ ਤੂੰ ਬਹੁਤ ਵਧੀਆ ਖੇਡ ਸਕਦਾ ਬਹੁਤ ਕੁਛ ਕਰ ਸਕਦਾ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਰਨਿੰਗ ਕਰ ਐਕਸਰਸਾਈਜ਼ ਕਰ ਵਗੈਰਾ ਜਦੋਂ ਮੈਂ ਰਨਿੰਗ ਕਰਨ ਜਾਂਦਾ ਸੀ ਤਾਂ ਮੇਰੇ ਪੈਰਾਂ ਵਿੱਚ ਇੰਜਰੀ ਹੋ ਜਾਂਦੀ ਸੀ ਤਾਂ ਉਹਨਾਂ ਨੇ ਮੈਨੂੰ ਐਕਸਰਸਾਈਜ਼ ਦੱਸੀਆਂ ਅਤੇ ਉਹਨਾਂ ਨੇ ਮੈਨੂੰ ਵਧੀਆ ਕੰਪਨੀ ਦੇ ਸ਼ੂਜ਼ ਲਿਆ ਕੇ ਦਿੱਤੇ ਜਿਸ ਨਾਲ ਮੈਂ ਵਧੀਆ ਜੰਪਿੰਗ ਰਨਿੰਗ ਵਗੈਰਾ ਕਰਨ ਲੱਗ ਪਿਆ ਰੱਸੀ ਲਿਆ ਕੇ ਦਿੱਤੀ ਰੱਸੀ ਟੱਪਣ ਲੱਗ ਪਿਆ ਜਿਸ ਨਾਲ ਮੇਰਾ ਸਟੈਮੀਨਾ ਬਿਲਡ ਹੋਇਆ ਅਤੇ ਸਟੈਮੀਨਾ ਬਿਲਡ ਹੋਣ ਕਰਕੇ ਮੈਂ ਹੁਣ ਫੁੱਟਬੋਲ 'ਚ ਬਹੁਤ ਵਧੀਆ ਖੇਡ ਲੈਂਦਾ ਹਾਂ ਅਤੇ ਜਿਸ ਕਰਕੇ ਮੇਰੇ ਹੁਣ ਪੈਰ ਵਿੱਚ ਪਹਿਲਾਂ ਇੰਜਰੀ ਵਗੈਰਾ ਹੋ ਜਾਂਦੀ ਸੀ ਹੁਣ ਮੇਰੇ ਪੈਰ ਵਿੱਚ ਇੰਜਰੀਸ ਨਹੀਂ ਹੁੰਦੀ ਅਤੇ ਅੱਜ ਦੇ ਟਾਈਮ 'ਤੇ ਮੈਂ ਬਹੁਤ ਵਧੀਆ ਖਿਡਾਰੀ ਬਣ ਚੁੱਕਿਆ ਹਾਂ ਫੁੱਟਬੋਲ ਦਾ ਅਤੇ ਮੈਨੂੰ ਬਹੁਤ ਨਾਜ ਹੈ ਅਤੇ ਇਸ ਨੂੰ ਮੈਂ ਆਪਣੇ ਲਾਈਫ 'ਤੇ ਇੰਪਲੀਮੈਂਟ ਕਰਦਾ ਹਾਂ ਅਤੇ ਮੈਨੂੰ ਆਪਣੇ ਆਪ 'ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਹਾਰ ਨਹੀਂ ਮੰਨੀ ਅਤੇ ਮੈਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ